ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪਹਿਲਾਂ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋ ਕੋਇ ਪਾਣੀ ਸਾਡੇ ਬਹੁਤ ਪਵਿੱਤਰ ਹੈ ਇਸ ਬਗੈਰ ਅਸੀਂ ਪਾਣੀ ਤੋਂ ਬਗੈਰ ਇੱਕ ਮਿੰਟ ਵੀ ਨਹੀਂ ਜੀਅ ਸਕਦੇ ਹਨ ਅਤੇ ਪਾਣੀ ਪਹਿਲਾਂ ਰਸੋਈ ਦੇ ਕੰਮ ਵਿੱਚ ਆਉਂਦਾ ਹੈ ਸਾਡਾ ਇਸ਼ਨਾਨ ਪਾਣੀ ਕਰਨਾ ਹੈ ਜਦੋਂ ਸਾਨੂੰ ਬਹੁਤ ਪਿਆਸ ਲੱਗਦੀ ਹੈ ਮਰੇ ਜਾਂਦੇ ਹਨ ਅਸੀਂ ਪਾਣੀ ਤੋਂ ਬਗੈਰ ਪਾਣੀ ਪੀ ਕੇ ਸਾਨੂੰ ਬਹੁਤ ਸਹੂਲਤ ਮਿਲ ਜਾਂਦੀ ਹੈ ਅਤੇ ਬਾਕੀ ਖੇਤੀ ਦੇ ਕੰਮਾਂ ਲਈ ਪਾਣੀ ਬਹੁਤ ਜ਼ਰੂਰੀ ਹੈ ਅਤੇ ਬਾਕੀ ਹੋਰ ਆਪਣੇ ਕੱਪੜੇ ਧੋਣ ਲਈ ਬਹੁਤ ਕਈ ਤਰ੍ਹਾਂ ਦੇ ਕੰਮਾਂ ਵਿੱਚ ਪਾਣੀ ਤੋਂ ਬਗੈਰ ਸਾਡਾ ਗੁਜਾਰਾ ਨਹੀਂ ਹੋ ਰਿਹਾ ਹੈ ਅਸੀਂ ਨਹੀਂ ਬੱਚ ਸਕਦੇ ਪਾਣੀ ਇੱਕ ਸਾਡਾ ਪਿਤਾ ਹੈ ਅਸੀਂ ਇਸ ਨੂੰ ਬਹੁਤ ਦਿਨੋਂ ਦਿਨ ਪਾਣੀ ਥੱਲੇ ਧਰਤੀ ਦੇ ਨੀਚੇ ਜਾ ਰਿਹਾ ਹੈ ਇਸ ਨੂੰ ਪਾਣੀ ਨੂੰ ਬਹੁਤ ਆਪਣੇ ਮਾਂ ਪਿਉ ਨਾਲੋਂ ਵੱਧ ਸਮਝ ਕੇ ਵਰਤਿਆ ਜਾਵੇ ਤਾਂ ਕਿ ਸਾਡਾ ਪਾਣੀ ਮਹਾਰਾਜ ਕਿਰਪਾ ਕਰੇ ਆਪਣਾ ਪਾਣੀ ਦੀ ਤੋਟ ਨਾ ਆਵੇ